ਪੰਜਾਬ ਵਿੱਚ ਬਹੁਤ ਜ਼ਿਆਦਾ ਉਪਲਬਧ ਹੈ ਜੈਸੇ ਡਿਸਪੈਂਸਰੀਆਂ ਹੋਸਪਿਟਲ ਦੇਸੀ ਇਲਾਜ ਠੀਕ ਹੈ ਹੋਮਾਂ ਵੈਦਿਕ ਦਵਾਈ ਜੋ ਹੋਮਾਂ ਵੈਦਿਕ ਦਵਾਈ ਹੈ ਉ ਘਰ ਵੀ ਕਰ ਸਕਦੇ ਅਸੀਂ ਜਿਸ ਤਰ੍ਹਾਂ ਡਿਸਪੈਂਸਰੀਆਂ ਉਹ ਵੀ ਪਿੰਡਾਂ 'ਚ ਉਪਲਬਧ ਹੈ ਅਸਾਨੀ ਨਾਲ ਜਾ ਸਕਦੇ ਅਸੀਂ ਜਿੱਦਾਂ ਹੋਸਪੀਟਲ ਹੈ ਬੰਦਾ ਆਪਣਾ ਗੱਡੀ 'ਤੇ ਜਾ ਸਕਦਾ ਬਾਇਕ 'ਤੇ ਜਾ ਸਕਦਾ ਆਪਣੇ ਕੋਈ ਵੀ ਸਾਧਨ ਤੋਂ ਬੰਦਾ ਜਾ ਸਕਦਾ ਠੀਕ ਹੈ